ਮੇਰਾ ਮੈਨੂੰ ਸਿਲਾਈ ਦਾ ਬਹੁਤ ਸ਼ੌਕ ਹੈ ਮੈਂ ਸਿਲਾਈ ਬਹੁਤ ਵਧੀਆ ਕਰਦੀ ਹਾਂ ਅਤੇ ਮੇਰੇ ਮੈਂ ਆਪਣੀ ਭੈਣ ਨੂੰ ਇੱਕ ਬਹੁਤ ਹੀ ਵਧੀਆ ਸੂਟ ਬਣਾ ਕੇ ਦਿੱਤਾ ਜਿਹਦੇ ਜਿਸ ਵਿੱਚ ਮੈਂ ਉਹਨੂੰ ਗੋਟੇ ਕਿਨਾਰੀਆਂਂ ਲਾ ਕੇ ਦਿੱਤੀਆਂ ਅਤੇ ਉਹਨੇ ਮੇਰਾ ਇਹ ਸੂਟ ਬਹੁਤ ਪਸੰਦ ਕੀਤਾ ਪਰ ਉਹਨੇ ਮੈਨੂੰ ਇਹ ਕਿਹਾ ਕਿ ਆ ਤੂੰ ਥੋੜ੍ਹਾ ਜਿਹਾ ਹੋਰ ਵਧੀਆ ਕਰ ਸਕਦੀ ਸੀ ਦੋ ਚਾਰ ਹੋਰ ਸਿਲਾਈਆਂ ਮਾਰ ਕੇ ਅਤੇ ਲੈਸਾਂ ਲਾ ਕੇ ਕਰ ਸਕਦੀ ਸੀ ਧੰਨਵਾਦ